ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਮਨਪਸੰਦ ਵਿਸ਼ੇ ਬਾਰੇ ਦੱਸਣ ਜਾ ਰਹੀ ਹਾਂ ਕਿ ਜੋ ਕਿ ਮੇਰਾ ਸਕੂਲ ਵਿੱਚ ਮਨਪਸੰਦ ਸੀ ਮੈਨੂੰ ਪੰਜਾਬੀ ਵਿਸ਼ਾ ਸਭ ਤੋਂ ਵਧੀਆ ਲੱਗਦਾ ਸੀ ਕਿਉਂਕਿ ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮੈਂ ਸ਼ੁਰੂ ਤੋਂ ਹੀ ਪੰਜਾਬੀ ਬੋਲਣਾ ਅਤੇ ਸੁਣਨਾ ਬੜਾ ਪਸੰਦ ਪਸੰਦ ਹੈ ਜਿਹੜਾ ਮੇਰਾ ਨਾਪਸੰਦ ਵਿਸ਼ਾ ਹੈ ਉਹ ਹਿਸਾਬ ਹੈ ਹਿਸਾਬ ਲੱਗਦਾ ਸੀ ਹਿਸਾਬ ਵਿੱਚ ਮੈਂ ਸ਼ੁਰੂ ਤੋਂ ਹੀ ਬੜੀ ਕਮਜ਼ੋਰ ਹਾਂ ਮੈਨੂੰ ਹਿਸਾਬ ਚੰਗੀ ਤਰ੍ਹਾਂ ਨਹੀਂ ਆਉਂਦਾ ਹਿਸਾਬ ਘਟਾਓ ਦੀ ਵਜ੍ਹਾ ਨਾਲ ਮੈਂ ਆਪਣੇ ਬਚਪਨ ਵਿੱਚ ਬੜੀ ਕੁੱਟ ਖਾਧੀ ਹੈ ਪਰ ਫਿਰ ਮੈਂ ਹਿਸਾਬ ਨਹੀਂ ਸੀ ਆਉਂਦਾ ਇਸ ਕਰਕੇ ਮੈਨੂੰ ਪੰਜਾਬੀ ਵਧੀਆ ਲੱਗਦੀ ਹੈ ਉਸ ਟਾਈਮ ਦੇ ਪੰਜਾਬੀ ਨੂੰ ਚੰਗਾ ਮੰਨਿਆ ਜਾਂਦਾ ਹੈ ਸਾਨੂੰ ਅੰਗਰੇਜ਼ੀ ਅਤੇ ਛੇਵੀਂ ਵਿੱਚ ਆਉਣ ਕੇ ਲੱਗੀ ਤਾਂ ਉਹ ਵੀ ਮੈਨੂੰ ਸਹੀ ਨਹੀਂ ਸੀ ਲੱਗਦੀ ਪਰ ਸਭ ਤੋਂ ਮਨਪਸੰਦ ਦੀ ਗੱਲ ਇਹ ਹੈ ਕਿ ਮੈਨੂੰ ਪੰਜਾਬੀ ਹੀ ਪਸੰਦ ਸੀ ਹੁਣ ਤਾਂ ਮੈਂ ਤੁਹਾਨੂੰ ਆਪਣੇ ਸਕੂਲ ਦੇ ਕੁਝ ਦਿਨਾਂ ਦੀ ਗੱਲ ਦੱਸਾਂਗੀ ਜੋ ਮੈਂ ਯਾਦ ਕਰਦੀ ਹਾਂ ਬੜਾ ਹੀ ਬੜਾ ਹੀ ਖੁਸ਼ ਹੁੰਦੀ ਹਾਂ ਕਿ ਕਿਸੇ ਟਾਈਮ 'ਤੇ ਇਕੱਲੀ ਬੈਠ ਕੇ ਹੱਸ ਵੀ ਪੈਂਦੀ ਸੀ ਪਹਿਲੀ ਤਾਂ ਮੇਰੀ ਸਕੂਲ ਦੀ ਟਾਈਮ 'ਤੇ ਮੇਰੀਆਂ ਬਹੁਤ ਯਾਦਾਂ ਹਨ ਪਰ ਕੁਝ ਯਾਦਾਂ ਕੁਝ ਸ਼ੁਰੂਆਤਾਂ ਜਦੋਂ ਮੈਨੂੰ ਯਾਦ ਆਉਂਦੀਆਂ ਹਨ ਤਾਂ ਬੜੀ ਖੁਸ਼ ਹੁੰਦੀ ਹਾਂ ਸਾਡੇ ਸਕੂਲ ਵਿੱਚ ਬਾਲ ਸਭਾ ਵੀ ਹੁੰਦੀ ਸੀ ਜਿਸ ਵਿੱਚ ਸਾਰੇ ਬੱਚੇ ਆਉਂਦੇ ਸਨ ਅਤੇ ਰਲ ਕੇ ਰੱਬ ਦਾ ਨਾਮ ਵੀ ਧਿਆਉਂਦੇ ਸਨ ਇਸ ਕਰਕੇ ਮੈਨੂੰ ਇਹ ਵੀ ਵਧੀਆ ਲੱਗਦਾ ਹੈ ਕਿਉਂਕਿ ਉਸ ਵਿੱਚ ਰੱਬ ਦਾ ਨਾਮ ਰੱਬ ਦਾ ਨਾਮ ਲੈ ਕੇ ਅਸੀਂ ਆਪਣੇ ਦਿਨ ਦੀ